ਮੈਂ ਲੋਨ ਦੇ ਲਈ ਅਰਜੀ ਦਿੱਤੀ ਹੈ ਸਭ ਤੋਂ ਪਹਿਲਾਂ ਮੈਂ ਬੈਂਕ ਵਿੱਚ ਗਈ ਅਤੇ ਬੈਂਕ ਵਾਲੇ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਸ ਚੀਜ਼ ਉੱਪਰ ਲੋਨ ਲੈਣਾ ਹੈ ਖਾਲੀ ਪਲਾਟ ਜਾਂ ਘਰ ਜਾਂ ਕਾਰ ਜਾਂ ਦੁਕਾਨ ਜਾਂ ਬਿਜਨਸ ਲੋਨ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਹੋਮ ਲੋਨ ਲੈਣਾ ਹੈ ਪ੍ਰਕਿਰਿਆ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਪੁੱਛਿਆ ਕਿ ਮੇਰਾ ਘਰ ਕਿੰਨੇ ਗਜ਼ ਦਾ ਹੈ ਅਤੇ ਮੇਰੇ ਘਰ ਦਾ ਐਡਰੈਸ ਕੀ ਹੈ ਉਹ ਕਿਸ ਸਥਿਤੀ ਦਾ ਹੈ ਉਸ ਦੀ ਕਿੰਨੀ ਵੈਲਿਊ ਹੈ ਅਤੇ ਆਸ ਪਾਸ ਦਾ ਮਾਹੌਲ ਕਿਵੇਂ ਦਾ ਹੈ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਘਰ ਸੱਠ ਲੱਖ ਰੁਪਏ ਦੀ ਵੈਲਿਊ ਦਾ ਹੈ ਅਤੇ ਇਸ ਲਈ ਉਹਨਾਂ ਨੇ ਮੈਨੂੰ ਚਾਰ ਲੱਖ ਰੁਪਏ ਦਾ ਲੋਨ ਦਿੱਤਾ ਇਸ ਸੰਬੰਧੀ ਉਨਾਂ ਨੇ ਮੇਰੀ ਰਜਿਸਟਰੀ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਕਾਗਜ਼ ਪੱਤਰ ਬੈਂਕ ਵਿੱਚ ਰੱਖ ਲਏ ਹਨ ਅਤੇ ਬਹੁਤ ਸਾਰੇ ਕਾਗਜ਼ਾਂ ਉੱਪਰ ਉਹਨਾਂ ਨੇ ਮੇਰੇ ਦਸਤਖਤ ਕਰਵਾਏ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਿੰਨੀਆਂ ਕਿਸ਼ਤਾਂ ਅਤੇ ਕਿੰਨੀ ਦੇਰ ਲਈ ਮੈਨੂੰ ਭਰਾਉਣੀਆਂ ਪੈਣਗੀਆਂ ਇਸ ਸੰਬੰਧੀ ਵੀ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਇਸ ਤੋਂ ਇਲਾਵਾ ਮੈਂ ਕ੍ਰੈਡਿਟ ਕਾਰਡ ਲਈ ਅਰਜੀ ਦੇਣ ਵਾਲੇ ਵਿਅਕਤੀ ਨੂੰ ਇਹੀ ਸਲਾਹ ਦਵਾਂਗੀ ਕਿ ਉਹ ਕ੍ਰੈਡਿਟ ਕਾਰਡ ਜ਼ਿਆਦਾ ਵੈਲਿਊ ਵਾਲੀ ਕੰਪਨੀ ਤੋਂ ਹੀ ਲਵੇ ਅਤੇ ਉਸ ਦੀ ਲਿਮਿਟ ਵੀ ਜ਼ਿਆਦਾ ਹੋਵੇ ਤਾਂ ਕਿ ਉਹਦੀ ਵੈਲਿਊ ਵੀ ਜ਼ਿਆਦਾ ਹੋਵੇ